ਜੀ ਹਾਂ ਮੈਂ ਪਹਾੜੀ ਇਲਾਕੇ ਵਿੱਚ ਗਿਆ ਹਾਂ ਅਜੇ ਥੋੜ੍ਹੇ ਸਮੇਂ ਪਹਿਲੇ ਦੀ ਗੱਲ ਹੈ ਜੋ ਕਿ ਹੋਲੀ ਵਿੱਚ ਸਾਨੂੰ ਛੁੱਟੀਆਂ ਹੁੰਦੀਆਂ ਸਨ ਸਾਨੂੰ ਕੰਮ ਤੋਂ ਛੁੱਟੀਆਂ ਹੁੰਦੀਆਂ ਸਨ ਇਸ ਕਰਕੇ ਆਪਾਂ ਸਾਰਾ ਇਕੱਠ ਕਰਕੇ ਆਪਾਂ ਘੁੰਮਣ ਗਏ ਹੋਏ ਸਨ ਆਪਾਂ ਬਾਈਕਾਂ 'ਤੇ ਹਰ ਸਾਲ ਮਨੀਕਰਨ ਸਾਹਿਬ ਹੋਰ ਜਿਵੇਂ ਕਿ ਮ ਕੁੱਲੂ ਮਨਾਲੀ ਵਗੈਰਾ ਵਾਲੀ ਸਲੋਂਗ ਵੈਲੀ ਥਾਵਾਂ 'ਤੇ ਜਾਂਦੇ ਹਨ ਅਤੇ ਇਸ ਤਰ੍ਹਾਂ ਮੈਂ ਆਪਣੇ ਇਕੱਠ ਨਾਲ ਗਿਆ ਸੀ ਅਤੇ ਮੈਂ ਉਸ ਸਮੇਂ ਦੌਰਾਨ ਆਪਣੇ ਇਕੱਠ ਤੋਂ ਵਿਛੜ ਗਿਆ ਸੀ ਜਿਵੇਂ ਕਿ ਸਲੋਂਗ ਵੈਲੀ ਵਿੱਚ ਆਪਾਂ ਸਲੋਂਗ ਵੈਲੀ ਵਿੱਚ ਆਪਾਂ ਰੀਵਰ ਰਾਫਟਿੰਗ ਵਗੈਰਾ ਕੀਤੀ ਅਤੇ ਉਹ ਮੇਰੇ ਦੋਸਤ ਜੋ ਕਿ ਮੇਰੇ ਤੋਂ ਪਿਛੜ ਗਏ ਸਨ ਇਸ ਕਰਕੇ ਮੈਂ ਉਹ ਥਾਂ 'ਤੇ ਗਵਾਚ ਗਿਆ ਸੀ ਲੇਕਿਨ ਮੈਂ ਉਹ ਰਸਤਾ ਆਪਣਾ ਇਸ ਤਰ੍ਹਾਂ ਲੱਭਿਆ ਕਿਉਂਕਿ ਮੈਂ ਜਦੋਂ ਵੀ ਉਸ ਰਸਤੇ ਤੋਂ ਆਇਆ ਸੀ ਅਤੇ ਮੈਂ ਉਸ ਰਸਤੇ ਵਿੱਚ ਆਪਣਾ ਕੀ ਕਹਿੰਦੇ ਆ ਆਪਣਾ ਰਸਤਿਆਂ ਵਿੱਚ ਉਹ ਥਾਂ ਦੀ ਪਹਿਚਾਣ ਕਰਦਾ ਜਾ ਰਿਹਾ ਸੀ ਅਤੇ ਇਸੇ ਤਰ੍ਹਾਂ ਮੈਂ ਉਹ ਰਸਤੇ ਨੂੰ ਆਪਣਾ ਲੱਭਦਾ ਜਾ ਰਿਹਾ ਸੀ ਅਤੇ ਇਸ ਕਰਕੇ ਮੈਂ ਆਪਣੇ ਦੋਸਤਾਂ ਨਾਲ ਫਿਰ ਵਾਪਸ ਤੋਂ ਉਹੀ ਥਾਂ 'ਤੇ ਆ ਮਿਲਿਆ ਸਾਡੇ ਫੋਨ ਕੋਂਟੈਕਟ ਵੀ ਉੱਥੇ ਜਾ ਕੇ ਬੰਦ ਹੋ ਗਏ ਸਨ ਕਿਉਂਕਿ ਸਾਡੀ ਸਿੰਮਾਂ ਜੋ ਹੈਗੀਆਂ ਸੀ ਉਹ ਉੱਥੋਂ ਦੀਆਂ ਨਹੀਂ ਚੱਲਦੀਆਂ ਸਨ ਸਾਡੇ ਅੰਬਰਸਰ ਦੀਆਂ ਸਿੰਮਾਂ ਹੀ ਉੱਥੇ ਚੱਲਦੀਆਂ ਨਹੀਂ ਸੀ ਇਸ ਕਰਕੇ ਸਾਨੂੰ ਆਪਾਂ ਉੱਥੋਂ ਦੀ ਸਿੰਮ ਵੀ ਨਹੀਂ ਲਿੱਤੀ ਸਨ ਇਸ ਕਰਕੇ ਮੈਂ ਉੱਥੇ ਆਪਣੇ ਦੋਸਤਾਂ ਨਾਲ ਕੋਂਟੈਕਟ ਵਿੱਚ ਵੀ ਨਹੀਂ ਰਹਿ ਪਾ ਰਿਹਾ ਸੀ ਲੇਕਿਨ ਮੈਂ ਕਿਸੇ ਤਰ੍ਹਾਂ ਵੀ ਉਹ ਰਸਤੇ ਨੂੰ ਆਪ ਲੱਭਿਆ ਅਤੇ ਫਿਰ ਮੈਂ ਆਪਣੇ ਦੋਸਤਾਂ ਨਾਲ ਜਾ ਮਿਲਿਆ ਅਤੇ ਉੱਥੇ ਮੈਂ ਆਪਣੀਆਂ ਸਾਵਧਾਨੀਆਂ ਵਰਤਣ ਵਾਸਤੇ ਮੈਂ ਆਪਣਾ ਪਹਿਲਾਂ ਘਰੋਂ ਹੈਲਥ ਇੰਸ਼ੋਰੈਂਸ ਵੀ ਕਰਵਾ ਕੇ ਗਿਆ ਸੀ ਤਾਂ ਕਿ ਜੋ ਕਿ ਮੈਨੂੰ ਉੱਥੇ ਕੋਈ ਪ੍ਰੇਸ਼ਾਨੀ ਨਾ ਹੋ ਸਕੇ ਅਤੇ ਮੈਂ ਆਪਣਾ ਦਵਾਈਆਂ ਵੀ ਘਰੋਂ ਲੈ ਕੇ ਗਿਆ ਸੀ ਤਾਂ ਕਿ ਜੋ ਕਿ ਮੈਨੂੰ ਰਾਹ ਵਿੱਚ ਕੋਈ ਥਕਾਵਟ ਵਗੈਰਾ ਹੋ ਜਾਂਦੀ ਹੈ ਕੋਈ ਸਿਰ ਪੀੜ ਵਗੈਰਾ ਹੋ ਜਾਂਦਾ ਹੈ ਤਾਂ ਕਿ ਮੈਂ ਉਹ ਦਵਾਈਆਂ ਨੂੰ ਖਾ ਸਕਾਂ ਅਤੇ ਆਪਣੇ ਸਰੀਰ ਨੂੰ ਵਧੀਆ ਰੱਖ ਸਕਾਂ ਇਸ ਤਰ੍ਹਾਂ ਦੀਆਂ ਸਾਨੂੰ ਸਾਵਧਾਨੀਆਂ ਹਰ ਹਮੇਸ਼ਾ ਵਰਤਣੀਆਂ ਰਹਿੰਦੀਆਂ ਚਾਹੀਦੀਆਂ ਹਨ ਕਿਉਂਕਿ ਜਦੋਂ ਵੀ ਆਪਾਂ ਕਿਤੇ ਘੁੰਮਣ ਵਗੈਰਾ ਜਾਂਦੇ ਹਨ ਤਾਂ ਸਾਨੂੰ ਇਹ ਚੀਜ਼ਾਂ ਦੀ ਬਹੁਤ ਜ਼ਰੂਰਤ ਹੁੰਦੀ ਹੈ ਇਸ ਤਰ੍ਹਾਂ ਹੀ ਸਾਨੂੰ ਜਗ੍ਹਾ 'ਤੇ ਜਾਣਾ ਰਹਿੰਦੇ ਚਾਹੀਦਾ ਹੈ